ਸਾਡੇ ਖੇਤਰ ਵਿੱਚ ਬਹੁਤ ਸਾਰੇ ਹਸਪਤਾਲ ਹਨ ਜਿਹਨਾਂ ਵਿੱਚ ਸਰਕਾਰੀ ਹਸਪਤਾਲ ਸਰਕਾਰ ਦੁਆਰਾ ਬਣਾਏ ਗਏ ਹਨ ਪਰ ਇਹਨਾਂ ਵਿੱਚ ਡਾਕਟਰਾਂ ਦੀ ਕਮੀ ਹੋਣ ਕਾਰਨ ਕਾਫ਼ੀ ਭੀੜ ਲੱਗੀ ਰਹਿੰਦੀ ਹੈ ਅਤੇ ਗਰੀਬ ਜਨਤਾ ਸਾਰੇ ਜਣੇ ਉੱਥੇ ਹੀ ਹੋਸਪੀਟਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ ਜਿ ਇਹਨਾਂ ਹੋਸਪੀਟਲਾਂ ਵਿੱਚ ਕਾਫ਼ੀ ਮਸ਼ੀਨਾਂ ਦੀ ਕਮੀ ਹੈ ਜਿਸ ਤਰ੍ਹਾਂ ਅਲਟ੍ਰਾਸਾਊਂਡ ਮਸ਼ੀਨ ਐਕਸਰੇਅ ਮਸ਼ੀਨ ਇਹਨਾਂ ਮਸ਼ੀਨਾਂ ਦੇ ਨਾ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪਹਿਲਾਂ ਤਾਂ ਡੋਕਟਰ ਹੀ ਹੋਸਪੀਟਲਾਂ ਵਿੱਚ ਘੱਟ ਹਨ ਜਦੋਂ ਡੋਕਟਰ ਹੁੰਦਾ ਹੈ ਤਾਂ ਇੱਕ ਇੱਕ ਡੋਕਟਰ ਅੱਗੇ ਕਾਫ਼ੀ ਪੇਸ਼ੈਂਟ ਖੜ੍ਹੇ ਹੁੰਦੇ ਹਨ ਜਦੋਂ ਡੋਕਟਰ ਸਲਿੱਪ ਬਣਾ ਕੇ ਦਿੰਦਾ ਹੈ ਤਾਂ ਇਹ ਇਹਨਾਂ ਦੇ ਇਹ ਅਲਟ੍ਰਾਸਾਊਂਡ ਜਾਂ ਐਕਸਰਾ ਹੋਸਪੀਟਲ ਵਿੱਚ ਨਹੀਂ ਹੋ ਪਾਉਂਦਾ ਅਤੇ ਮਰੀਜ਼ ਨੂੰ ਬਾਹਰ ਜਾਣਾ ਪੈਂਦਾ ਹੈ ਬਾਹਰ ਜਾ ਕੇ ਜਦੋਂ ਐਕਸਰਾ ਜਾਂ ਅਲਟ੍ਰਾਸਾਊਂਡ ਦੀ ਰਿਪੋਰਟ ਆਉਂਦੀ ਹੈ ਤਾਂ ਡਾਕਟਰ ਚਲੇ ਜਾਂਦਾ ਹੈ ਡਾਕਟਰ ਟਾਈਮ ਤੋਂ ਪਹਿਲਾਂ ਜਾਣ ਦੇ ਨਾਲ ਡੋਕਟਰ ਨਹੀਂ ਦੇਖ ਪਾਉਂਦਾ ਕਿ ਮਰੀਜ਼ ਕਿਸ ਹਾਲਤ ਵਿੱਚ ਹੈ ਅਤੇ ਬਾਅਦ ਵਿੱਚ ਡੋਕਟਰਾਂ ਨੇ ਆਪਣੇ ਪ੍ਰਾਈਵੇਟ ਹੋਸਪੀਟਲ ਖੋਲ੍ਹੇ ਹੋਏ ਹਨ ਜਿਨ੍ਹਾਂ ਹੋਸਪੀਟਲਾਂ ਕਰਕੇ ਡੋਕਟਰ ਜ਼ਿਆਦਾ ਧਿਆਨ ਆਪਣੇ ਹੋਸਪੀਟਲਾਂ ਵਿੱਚ ਦਿੰਦੇ ਹਨ ਅਤੇ ਲੋਕਾਂ ਨੂੰ ਉੱਥੇ ਆਉਣ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਲੋਕ ਬਾਹਰ ਪ੍ਰਾਈਵੇਟ ਹੋਸਪੀਟਲ ਵਿੱਚ ਜਾਂਦੇ ਹਨ ਤਾਂ ਲੋਕਾਂ ਦਾ ਆਪਣਾ ਪੈਸਾ ਬਰਬਾਦ ਹੁੰਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਪ੍ਰਾਈਵੇਟ ਕਲੀਨਿਕ ਬੰਦ ਕਰਵਾਏ ਜਾਣ ਅਤੇ ਡੋਕਟਰਾਂ ਦੀ ਕਮੀ ਨੂੰ ਹੋਸਪੀਟਲਾਂ ਵਿੱਚ ਪੂਰਾ ਕੀਤਾ ਜਾਵੇ